ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਮੇਰਾ ਨਾਮ ਸਤਿਆਮ ਹੈ ਸ਼ੋਅਰ ਬੱਚੇ ਸ਼ੋਅਰ ਬੱਚੇ ਅੱਛਾ ਤੁਸੀਂ ਮੈਨੂੰ ਆਪਣੇ ਜਿਹੜਾ ਕੁਆਲੀਫਿਕੇਸ਼ਨ ਦੱਸ ਸਕਦੇ ਹੋ ਕਿ ਤੁਸੀਂ ਕੀ ਕਰਨ ਦੇ ਹੋ ਜਾਂ ਕਰ ਲਿਆ ਜੇ ਠੀਕ ਹੈ ਬੱਚੇ ਬਹੁਤ ਵਧੀਆ ਬਹੁਤ ਸੋਹਣਾ ਮੈਂ ਤਾਂ ਕਹਿ ਰਿਹਾ ਸੀ ਤੁਸੀਂ ਮੇਰੇ ਸੈਂਟਰ ਆ ਜਾਓ ਮੇਰਾ ਲੋਕਲ ਸੈਂਟਰ ਆ ਪੁਤਲੀ ਘਰ ਦੇ ਨੇੜੇਲੇ ਚੌਂਕ 'ਚ ਸਥਿਤ ਹੈ ਹੈਗਾ ਏ ਤੁਸੀਂ ਮੇਰੇ ਕੋਲ ਆ ਕੇ ਕੋਂਟੈਕਟ ਕਰ ਲਿਓ ਮੈਨੂੰ ਭਾਵੇਂ ਜਦੋਂ ਮਰਜ਼ੀ ਕੋਂਟੈਕਟ ਕਰੋ ਮੈਂ ਤੁਹਾਡੀ ਹੰਡਰਡ ਪਰਸੈਂਟ ਪਲੇਸਮੈਂਟ ਗਰੈਂਟਿਡ ਕਰਦਾ ਆ ਬਸ ਤੁਸੀਂ ਬੱਚੇ ਆਪਣੇ ਨਾ ਥੋੜ੍ਹੀ ਸਟੱਡੀਜ਼ ਦਾ ਧਿਆਨ ਰੱਖੋ ਕਿਉਂਕਿ ਅੱਜ ਕੱਲ੍ਹ ਥੋੜ੍ਹਾ ਕੰਪਨੀਜ਼ ਲੇ ਔਫ ਜਿਵੇਂ ਕਰ ਰਹੀਆਂ ਨੇ ਅਤੇ ਥੋੜ੍ਹਾ ਆਪਣੇ ਸਟੱਡੀਜ ਦਾ ਧਿਆਨ ਰੱਖਿਓ ਬਸ ਬਾਕੀ ਤੁਸੀਂ ਬੱਚੇ ਤੁਹਾਡੇ ਮੈਂ ਪੁੱਛ ਸਕਦਾਂ ਕਿ ਤੁਹਾਡੀ ਕਿੰਨੀ ਪ੍ਰਸੈਂਟੇਜ ਆਈ ਸੀ ਆਪਣੇ ਬੀਟੈਕ 'ਚ ਠੀਕ ਏ ਕੋਈ ਨਹੀਂ ਬੱਚੇ ਤੁਸੀਂ ਕੱਲ੍ਹ ਮੇਰੇ ਆਫਿਸ ਆ ਜਾਓ ਅਤੇ ਮੈਂ ਤੁਹਾਨੂੰ ਉੱਧਰ ਆ ਕੇ ਸਭ ਕਲੀਅਰ ਆਊਟ ਕਰ ਦੂੰਗਾ ਓ ਧੰਨਵਾਦ